ਪੰਜਾਬ ਦੇ ਵਿੱਚ ਕਈ ਜਿਵੇਂ ਹੜੱਪਨ ਸਿਵਲਾਈਜੇਸ਼ਨ ਜਾਂ ਹੜੱਪਾ ਸੱਭਿਅਤਾ ਅਸੀਂ ਉਹ ਨੂੰ ਕਹਿ ਸਕਦੇ ਹਾਂ ਉਸ ਟਾਈਮ ਦੀ ਜਿਹੜੀ ਕਲਾ ਸ਼ੈਲੀਆਂ ਹੈ ਆ ਜਿਵੇਂ ਕਿ ਚਿੱਤਰਕਲਾ ਹੋ ਗਈਆਂ ਉਸ ਟਾਈਮ ਦੀ ਜਿਹੜੇ ਲ ਲੋਕ ਸੀ ਉਹ ਕੰਧ ਦੇ ਵਿੱਚ ਜੋ ਅੱਖਰਾਂ ਨੂੰ ਉਕੇਰ ਕੇ ਆਪਣੇ ਆਪਸ ਦੇ ਵਿੱਚ ਗੱਲਬਾਤ ਕਰਦੇ ਸੀ ਅਤੇ ਇਹੀ ਉਹਨਾਂ ਦੇ ਕਲਾ ਦਾ ਆਪਣੇ ਕਲਾ ਨੂੰ ਦਿਖਾਉਣ ਦਾ ਜ਼ਰੀਆ ਸੀ ਅਤੇ ਉਹ ਇੱਕ ਦੂਜੇ ਨਾਲ ਆਪਣੇ ਸੱਭਿਆਚਾਰਨ ਹੋ ਗਏ ਆਪਣੇ ਦਿਲ ਦੀਆਂ ਗੱਲਾਂ ਹੋ ਗਈਆਂ ਉਹਨਾਂ ਨੂੰ ਉਹ ਆਪਣੀ ਕਲਾ ਦੇ ਰਾਹੀਂ ਹੀ ਇੱਕ ਦੂਜੇ ਨੂੰ ਮਤਲਬ ਸਮਝਾ ਸਕਦੇ ਸੀ